ਸਾਡੇ ਕੋਲ ਪੁਰਾਣੀਆਂ ਫੋਟੋਆਂ ਦੀ ਇੱਕ ਪੁਰਾਣੀ ਐਲਬਮ ਹੈਗੀ ਹੈ ਜਿਸ ਵਿੱਚ ਜੋ ਕੋ ਕਾਫ਼ੀ ਪੁਰਾਣੀ ਹੈ ਪਹਿਲੇ ਸਮੇਂ ਦੇ ਵਿੱਚ ਕੁਛ ਬਲੈਕ ਐਂਡ ਵਾਈਟ ਕੈਮਰੇ ਸੀ ਅਤੇ ਕਲਰਫੁੱਲ ਕੈਮਰੇ ਆਏ ਅਤੇ ਉਸ ਤੋਂ ਬਾਅਦ ਹੁਣ ਤਾਂ ਡਿਜ਼ੀਟਲ ਜ਼ਮਾਨਾ ਚੱਲ ਗਿਆ ਪੁਰਾਣੀਆਂ ਫੋਟੋਆਂ ਜੇ ਵਿੱਚ ਥੋੜ੍ਹੀ ਜਿਹੀ ਸੀਗਾ ਕਿ ਸੱਭਿਆਚਾਰਕ ਸੀ ਸੱਭਿਆਚਾਰ ਝਲਕਦਾ ਸੀ ਅਤੇ ਕੁਛ ਥੋੜ੍ਹੀ ਸੰਗ ਸੀ ਅਤੇ ਸਮਾਂ ਸੀ ਲੋਕਾਂ ਕੋਲ ਅਤੇ ਇਸ ਕਰਕੇ ਉਹ ਪੁਰਾਣੀਆਂ ਫੋਟੋਆਂ ਦੇ ਵਿੱਚ ਯਾਦ ਆਉਂਦਾ ਹੈ ਅਤੇ ਕੁਛ ਸਾਡੇ ਪੁਰਾਣੀਆਂ ਫੋਟੋਆਂ ਦੇ ਵਿੱਚ ਗੁਆਚ ਗਏ ਸੱਜਣ ਮਿੱਤਰ ਸਾਡੇ ਰਿਸ਼ਤੇਦਾਰ ਜੋ ਕਿ ਇਸ ਦੁਨੀਆ ਨੂੰ ਅਲਵਿਦਾ ਆਖ ਜਾਂਦੇ ਨੇ ਉਹ ਮਿਲ ਜਾਂਦੇ ਹੈ ਅਤੇ ਇਸ ਕਰਕੇ ਓ ਉਹਨਾਂ ਨਾਲ ਜ਼ਿਆਦਾ ਭਾਵਨਾ ਤਾਂ ਜੁੜ ਜਾਂਦੀ ਹੈ ਕੁਛ ਪੁਰਾਣਾ ਸਮਾਂ ਯਾਦ ਆ ਜਾਂਦਾ ਹੈ ਕੁਛ ਸਾਡਾ ਬੀਤ ਗਿਆ ਟਾਇਮ ਚੇਤੇ ਆ ਜਾਂਦਾ ਸਮਾਂ ਜਿਵੇਂ ਕਿ ਉਸ ਸਮੇਂ ਸਾਡੇ 'ਤੇ ਜਵਾਨੀ ਸੀ ਸਾਰਾ ਕੁਛ ਜਵਾਨੀ ਦਾ ਸਮਾਂ ਯਾਦ ਆ ਜਾਂਦਾ ਹੈ ਨਵਾਂ ਡਿਜ਼ੀਟਲ ਤਰੀਕਾ ਜਿਹੜਾ ਹੈ ਇਹ ਹੁਣ ਪਹਿਲਾਂ ਤਾਂ ਐਲਬੰਮ ਬਣਦੀ ਸੀ ਹੁਣ ਐਲਬੰਮ ਬਣਦੀ ਹੈ ਡਿਜ਼ੀਟਲ ਪ੍ਰਿਟਿੰਡ ਆਉਂਦੀਆਂ ਨੇ ਅਤੇ ਹੁਣ ਇਹ ਸਾਰਾ ਕੁਛ ਵੈਸਟਰਨ ਹੋ ਗਿਆ ਹੈ ਫੈਸ਼ਨ ਜ਼ਿਆਦਾ ਹੋ ਗਿਆ ਹੈ ਅਤੇ ਇਸ ਕਰਕੇ ਇਹਦੇ ਨਾਲੋਂ ਜਿਹੜੀਆਂ ਪੁਰਾਣੀਆਂ ਫੋਟੋਆਂ ਸੀ ਉਹ ਬਹੁਤ ਵਧੀਆ ਸੀ ਉਹਨਾਂ ਦੇ ਵਿੱਚ ਸਾਡਾ ਸੱਭਿਆਚਾਰ ਝਲਕਦਾ ਸੀ